ਬਾਈਕਿੰਗ ਜਾਂ ਮੋਟਰਸਾਈਕਲ ਚਲਾਉਣਾ ਆਪਣੇ ਸ਼ੌਕ ਸ਼ੌਕ ਦੀ ਗੱਲ ਹੈ ਜੋ ਬੰਦਾ ਮੋਟਰਸਾਈਕਲ ਆਪਣੇ ਸ਼ੌਕ ਲਈ ਚਲਾਉਂਦਾ ਹੈ ਉਸਨੂੰ ਵੱਧਦੇ ਤੇਲ ਦੇ ਦਾਮ ਕੁਛ ਨਹੀਂ ਆਖਦੇ ਪਰ ਅੰਦਰੋਂ ਅੰਦਰ ਇੱਕ ਦਿੱਕਤ ਤਾਂ ਜ਼ਰੂਰ ਦਿੰਦੇ ਹਨ ਕਿ ਵੱਧਦੇ ਮੋਟਰਸਾਈਕਲ ਦੇ ਦਾਮ ਕਰਕੇ ਖਰਚੇ ਜ਼ਰੂਰ ਵੱਧ ਜਾਂਦੇ ਹਨ ਪਰ ਸ਼ੌਕ ਦਾ ਕੋਈ ਮੁੱਲ ਨਹੀਂ ਜੋ ਬੰਦਾ ਸ਼ੌਕ ਵਜੋਂ ਮੋਟਰਸਾਈਕਲ ਚਲਾਉਂਦਾ ਹੈ ਉਹ ਬੜੇ ਹੀ ਆਰਾਮ ਨਾਲ ਵੱਧਦੇ ਤੇਲ ਦੇ ਖਰਚੇ ਨੂੰ ਵੀ ਦੇਖ ਕੇ ਉਸ ਉੱਤੇ ਕੰਮ ਕਰ ਲੈਂਦਾ ਹੈ ਅਤੇ ਆਪਣੇ ਸ਼ੌਕ ਪੂਜ ਲੈਂਦਾ ਹੈ ਪਰ ਜਿਸ ਬੰਦੇ ਨੂੰ ਆਪਣੀ ਮਜ਼ਬੂਰੀ ਲਈ ਮੋਟਰਸਾਈਕਲ ਚਲਾਉਣਾ ਪੈਂਦਾ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਪੈਂਦਾ ਹੈ ਉਸ ਨੂੰ ਵੱਧਦੇ ਤੇਲ ਦੇ ਦਾਮ ਤੰਗ ਕਰਦੇ ਹਨ ਜਿੱਦਾਂ ਕਿ ਮੈਂ ਮੋਟਰਸਾਈਕਲ ਸ਼ੌਕ ਲਈ ਚਲਾਉਂਦਾ ਹਾਂ ਆਪਣੇ ਮਨ ਨੂੰ ਹਲਕਾ ਕਰਨ ਲਈ ਚਲਾਉਂਦਾ ਹਾਂ ਅਤੇ ਆਪਣੇ ਸ਼ੌਕ ਪੂਜਣ ਲਈ ਅਲੱਗ ਅਲੱਗ ਜਗ੍ਹਾ ਘੁੰਮਣ ਲਈ ਅਤੇ ਬਹੁਤ ਜਗ੍ਹਾ ਦੇਖਣ ਲਈ ਮੋਟਰਸਾਈਕਲ ਚਲਾਉਂਦਾ ਹਾਂ ਇਸ ਲਈ ਮੈਨੂੰ ਮੋਟਰਸਾਈਕਲ ਕੁਝ ਖਾਸ ਮੋਟਰਸਾਈਕਲ ਦੇ ਕਾਰਨ ਵੱਧਦੇ ਤੇਲ ਦੇ ਦਾਮ ਕੁਝ ਖਾਸ ਤੰਗ ਨਹੀਂ ਕਰਦੇ ਮੇਰਾ ਮੋਟਰਸਾਈਕਲ ਚਲਾਉਣ ਦਾ ਸ਼ੌਕ ਸ਼ੁਰੂਆਤ ਤੋਂ ਹੀ ਹੈ ਅਤੇ ਮੇਰੇ ਕੋਲ ਆਪਣਾ ਇੱਕ ਇੰਟਰਸੈਪਟਰ ਸਾਢ਼ੇ ਛੇ ਸੌ ਬੁਲੇਟ ਵੀ ਖੜ੍ਹਾ ਹੈ ਜਿਸ ਜੋ ਕਿ ਬਹੁਤ ਹੀ ਤਗੜਾ ਅਤੇ ਬਹੁਤ ਹੀ ਸ਼ਕਤੀਸ਼ਾਲੀ ਇੰਜਣ ਵਾਲਾ ਇੱਕ ਮੋਟਰਸਾਈਕਲ ਹੈ ਇਸ ਦੀ ਐਵਰੇਜ ਵੀ ਕੁਝ ਖਾਸ ਨਹੀਂ ਹੈ ਇਹ ਮੈਨੂੰ ਇੱਕ ਲੀਟਰ ਵਿੱਚ ਤ ਵੀਹ ਤੋਂ ਪੱਚੀ ਦੀ ਐਵਰੇਜ ਹੀ ਕੱਢ ਕੇ ਦਿੰਦਾ ਹੈ ਜੋ ਕਿ ਆਮ ਤੌਰ ਇੱਕ ਗੱਡੀ ਦੀ ਐਵਰੇਜ ਜਿੰਨੀ ਹੋ ਜਾਂਦੀ ਹੈ ਜੇ ਉਸਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ ਇਸਦੀ ਐਵਰੇਜ ਘੱਟ ਹੋਣ ਕਾਰਨ ਮੈਨੂੰ ਕੋਈ ਦਿੱਕਤ ਨਹੀਂ ਓਂ ਦਿੱਕਤ ਆਉਂਦੀ ਹੈ ਬਟ ਮੇਰਾ ਆਪਣਾ ਸ਼ੌਕ ਹੈ ਕਿਉਂਕਿ ਮੈਨੂੰ ਇਸ ਨੂੰ ਚਲਾ ਕੇ ਇੱਕ ਆਰਾਮ ਅਤੇ ਮਜ਼ਾ ਆਉਂਦਾ ਹੈ ਮੈਂ ਇਸ ਨੂੰ ਇਸ ਲਈ ਚਲਾਉਂਦਾ ਹਾਂ ਅਤੇ ਵੱਧਦੇ ਤੇਲ ਦੇ ਦਾਮ ਮੈਨੂੰ ਇਸ ਨੂੰ ਤੁ ਕੁਛ ਖਾਸ ਤੰਗ ਨਹੀਂ ਕਰਦੇ ਬਾਲਣ ਦੀ ਜ਼ਿਆਦਾ ਵਰਤੋਂ ਨੁਕਸਾਨ ਦੇਹ ਤਾਂ ਜ਼ਰੂਰ ਹੈ ਕਿਉਂਕਿ ਅੱਜ ਕੱਲ ਜੋ ਧਰਤੀ ਦੇ ਹਾਲਾਤ ਹੁੰਦੇ ਜਾ ਰਹੇ ਹਨ ਇਸ ਨਾਲ ਧਰਤੀ ਨੂੰ ਬਹੁਤ ਜ਼ਿਆਦਾ ਲੋੜ ਹੈ ਕਿ ਸੰਭਾਲਿਆ ਜਾਵੇ ਅਤੇ ਇਸਦੀ ਕੇਅਰ ਕੀਤੀ ਜਾਵੇ ਬਾਲਣ ਜ਼ਿਆਦਾ ਹੋਣ ਕਾਰਨ ਧਰਤੀ 'ਤੇ ਗਲੋਬਲ ਵਾਰਮਿੰਗ ਵੱਧਦੀ ਹੈ ਧਰਤੀ ਦਾ ਤਾਪਮਾਨ ਵੱਧਦਾ ਹੈ ਅਤੇ ਵੱਧਦੇ ਤਾਪਮਾਨ ਕਾਰਨ ਦਿੱਕਤ ਇਹ ਆਉਂਦੀ ਹੈ ਕਿ ਫਸਲਾਂ ਉੱਤੇ ਅਸਰ ਪੈਂਦਾ ਹੈ ਅਤੇ ਰੋਜ਼ਮੱਰਾ ਦੇ ਉੱਤੇ ਵੀ ਅਸਰ ਪੈਂਦਾ ਹੈ ਮੌਸਮ ਦੇ ਵਿੱਚ ਬਦਲਾਅ ਦੇਖਿਆ ਜਾ ਸਕਦਾ ਹੈ ਅਤੇ ਇਸ ਕਾਰਨ ਬਾਲਣ ਦੀ ਵਰਤੋਂ ਨੂੰ ਬਹੁਤ ਹੀ ਤਰੀਕੇ ਨਾਲ ਕੀਤਾ ਜਾਵੇ ਅਤੇ ਵੱ ਜ਼ਿਆਦਾ ਬਾਲਣ ਜ਼ਿਆਦਾ ਬਾਲਣ ਫੂਕਣ ਨਾਲ ਵੀ ਧਰਤੀ ਨੂੰ ਅਸਰ ਪੈਂਦਾ ਹੈ ਅਤੇ ਘੱਟ ਬਾਲਣ ਫੂਕਣ ਨਾਲ ਧਰਤੀ ਨੂੰ ਵੀ ਬਚਾਅ ਰਹਿੰਦਾ ਹੈ ਅਤੇ ਤੁਹਾਡੇ ਕੰਮ ਵੀ ਵਧੀਆ ਹੁੰਦੇ ਰਹਿੰਦੇ ਹਨ ਧਰਤੀ ਦਾ ਬਚਾਅ ਇਸ ਤੀ ਇਸ ਟਾਈਮ 'ਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅਤੇ ਇਹ ਬਾਲਣ ਦੀ ਘੱਟ ਵਰਤੋਂ ਕਰਕੇ ਹੋਰ ਨੈਚੁਰਲ ਰਿਸੋਰਸ ਵਰਤ ਕੇ ਜਿੱਦਾਂ ਕਿ ਪਾਣੀ ਨੂੰ ਪਾਣੀ ਉੱਤੇ ਚੱਲਣ ਵਾਲੇ ਇੰਜਣ ਬਣਾ ਕੇ ਇਸ ਚੀਜ਼ ਨੂੰ ਹੋਰ ਕੰਮ ਕੀਤਾ ਜਾ ਸਕਦਾ ਹੈ ਤਾਂ ਜੋ ਆਪਣੇ ਧਰਤੀ ਦੇ ਵਾਤਾਵਰਨ ਨੂੰ ਬਚਾਇਆ ਜਾ ਸਕੇ